ਮੇਰਾ ਜਨਮ ਪੰਜਾਬ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਹੈ ਮੇਰੀ ਮਾਤ ਭਾਸ਼ਾ ਪੰਜਾਬੀ ਹੈ ਮੈਂ ਅਤੇ ਮੇਰਾ ਪਰਿਵਾਰ ਪੰਜਾਬੀ ਬੋਲਦੇ ਹਾਂ ਅਸੀਂ ਸਾਰੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਪ ਪਿਆਰ ਕਰਦੇ ਹਾਂ ਮੈਨੂੰ ਪੰਜਾਬੀ ਸੂਟ ਪੰਜਾਬੀ ਜੁੱਤੀ ਪਾਉਣਾ ਬਹੁਤ ਚੰਗਾ ਲੱਗਦਾ ਹੈ ਜੋ ਕਿ ਸਾਡੇ ਸੱਭਿਆਚਾਰ ਦ ਸੱਭਿਆਚਾਰ ਅਤੇ ਪੰਜਾਬੀਅਤ ਦੀ ਪਛਾਣ ਹੈ ਮੈਨੂੰ ਪੰਜਾਬੀ ਨਾਲ ਬਹੁਤ ਪਿਆਰ ਹੈ ਜੋ ਕਿ ਮੇਰੀ ਅਸਲ ਪਹਿਚਾਣ ਹੈ